ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਮਾਲ ਟੇਲਰ ਤੋਂ ਬਰਨਾਲਾ ਤੋਂ ਬੋਲਦੇ ਹੋ ਜੀ ਹਾਂਜੀ ਜੀ ਅਸੀਂ ਨਾ ਵੀਰ ਜੀ ਕੱਪੜੇ ਸਟਿੱਚ ਕਰਵਾਉਣੇ ਸੀਗੇ ਸਾਡੇ ਗਵਾਂਢ 'ਚੋਂ ਕਰਵਾਏ ਸੀਗੇ ਅਤੇ ਸਾਨੂੰ ਵਧੀਆ ਲੱਗੀ ਸਾਡੇ ਮੈਰਿਜ ਆ ਜੀ ਘਰ ਅਤੇ ਅਸੀਂ ਕਹਿ ਲਉ ਵੀ ਬੱਚਿਆਂ ਲਈ ਇੱਕ ਬੇਟੇ ਦੀ ਹੈ ਜੀ ਅਤੇ ਜੈਂਟਸ ਮੇਰੇ ਹਸਬੈਂਡ ਦੇ ਹੈ ਜੀ ਅਤੇ ਮੇਰੇ ਕੱਪੜੇ ਅਤੇ ਹਾਂਜੀ ਅਤੇ ਕਹਿਣ ਦਾ ਭਾਵ ਤੁਸੀਂ ਹਰੇਕ ਤਰ੍ਹਾਂ ਦੇ ਕੱਪੜੇ ਪੈਕ ਸਟਿੱਚ ਕਰ ਲੈਂਦੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਤੁਸੀਂ ਆਪ ਦਾ ਐਡਰੈਸ ਦੱਸ ਦਿਉਂਗੇ ਜੀ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਅਤੇ ਸਮਾਈ ਦਾ ਕੀ ਹਿਸਾਬ ਕਿਤਾਬ ਆ ਜੀ

ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਅਤੇ ਵੀਰ ਜੀ ਫਿਰ ਅਸੀਂ ਕੱਲ ਨੂੰ ਸੁਬਹ ਆਈਏ ਠੀਕ ਹੈ ਦੁਕਾਨ ਕਿੰਨੇ ਵਜੇ ਓਪਨ ਕਰਦੇ ਹੋ ਜੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਥੈਂਕ ਯੂ ਜੀ ਹਾਂਜੀ ਨਹੀਂ ਜੀ ਅਸੀਂ ਕੱਲ ਨੂੰ ਆਵਾਂਗੇ ਸੁਬਹ ਆ ਜਾਵਾਂਗੇ ਜੀ ਅ ਹਾਂਜੀ ਥੈਂਕ ਯੂ ਵੀਰ ਜੀ ਥੈਂਕ ਯੂ ਜੀ